ਖੇਤੀਬਾੜੀ ਕਰਨ ਵਿੱਚ ਸਾਡਾ ਕਾਫ਼ੀ ਸਮਾਂ ਜਿਹੜਾ ਵਾ ਬਤੀਤ ਹੋ ਜਾਂਦਾ ਹੈ ਜਿਸ ਵਿੱਚ ਸੀਜ਼ਨ ਦੌਰਾਨ ਤਾਂ ਅਸੀਂ ਅੱਠ ਦਸ ਘੰਟੇ ਵੀ ਉੱਥੇ ਖੇਤ ਵਿੱਚ ਜਾ ਕੇ ਕੰਮ ਕਰਨਾ ਪੈਂਦਾ ਹੈ ਅਤੇ ਇਸ ਤੋਂ ਇਲਾਵਾ ਜਦ ਥੋੜ੍ਹਾ ਜਿਹਾ ਕੰਮ ਘੱਟ ਵੀ ਹੋਵੇ ਤਾਂ ਅਸੀਂ ਉਸ ਖੇਤ ਵਿੱਚ ਜਾ ਕੇ ਖੇਤ ਦੀ ਪੂਰੀ ਨਿਗਰਾਨੀ ਕਰੀਦੀ ਆ ਉਸ ਵਿੱਚ ਕੋਈ ਪਾਣੀ ਦੀ ਜ਼ਰੂਰਤ ਆ ਕੋਈ ਕਿਸੇ ਕੀਟਨਾਸ਼ਕ ਦੀ ਜ਼ਰੂਰਤ ਆ ਜਾਂ ਕਿਸੇ ਤਰ੍ਹਾਂ ਹੈ ਉਸ ਨੂੰ ਅਸੀਂ ਆਰਗੈਨਿਕ ਤਰੀਕੇ ਨਾਲ ਆਪਣਾ ਹੱਲ ਕਰਦੇ ਹਾਂ ਅਤੇ ਜੇ ਫਿਰ ਵੀ ਕਿਸੇ ਖੇਤੀ ਦਾ ਕੰਮ ਕਰਨਾ ਸਿਹਤ ਪੱਖੋਂ ਜਿਹੜਾ ਵਾ ਬਹੁਤ ਵਧੀਆ ਰਹਿੰਦਾ ਵਾ ਖੇਤੀ ਕਰਨ ਦੇ ਨਾਲ ਸਿਹਤ ਬਹੁਤ ਵਧੀਆ ਰਹਿੰਦੀ ਹੈ ਇਸ ਨਾਲ ਸਰੀਰ ਵਿੱਚ ਕੋਈ ਲੀਵਰ ਦੀ ਪ੍ਰੋਬਲਮ ਕੋਈ ਵਿਟਾਮਿਨ ਡੀ ਦੀ ਕਮੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਘਾਟਾਂ ਨੇ ਉਸ ਵਿੱਚ ਪੂਰੀਆਂ ਹੋ ਜਾਂਦੀਆਂ ਹਨ ਅਤੇ ਖੇਤੀ ਕਰਨ ਦੇ ਨਾਲ ਸਿਹਤ ਠੀਕ ਰਹਿੰਦੀ ਹੈ ਅਤੇ ਸਾਨੂੰ ਤਾਜ਼ੀਆਂ ਫ਼ਲ ਅਤੇ ਸਬਜ਼ੀਆਂ ਮਿਲਦੀਆਂ ਹਨ ਅਤੇ ਉਸਨੂੰ ਅਸੀਂ ਖਾ ਕੇ ਆਪਣਾ ਵਧੀਆ ਕੰਮ ਕਰਦੇ ਹਾਂ